ਜੀ ਨਹੀਂ ਮੈਂ ਮੱਧ ਪੀੜ੍ਹੀ ਦਾ ਹਿੱਸਾ ਨਹੀਂ ਹਾਂ ਮੈਂ ਨੌਜਵਾਨ ਪੀੜ੍ਹੀ ਦਾ ਹਿੱਸਾ ਹਾਂ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਦੇ ਵਿਚਕਾਰ ਸੰਤੁਲਨ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਜ਼ਿੰਦਗੀ ਨੂੰ ਸੁਖਾਲੇ ਢੰਗ ਨਾਲ ਬਤੀਤ ਕੀਤਾ ਜਾ ਸਕੇ ਕਿਉਂਕਿ ਇੱਕ ਹੀ ਪਰਿਵਾਰ ਦੇ ਵਿੱਚ ਪੁਰਾਣੀ ਪੀੜ੍ਹੀ ਜਿਵੇਂ ਕਿ ਬਜ਼ੁਰਗ ਦਾਦਾ ਦਾਦੀ ਅਤੇ ਨੌਜਵਾਨ ਪੀੜ੍ਹੀ ਜਿਸ ਵਿੱਚ ਪੋਤਾ ਪੋਤੀ ਆ ਜਾਂਦੇ ਹਨ ਦੋਨਾਂ ਨੇ ਇੱਕ ਹੀ ਪਰਿਵਾਰ ਵਿੱਚ ਇਕੱਠੇ ਰਹਿਣਾ ਹੁੰਦਾ ਹੈ ਪਰ ਦੋਨਾਂ ਦੀ ਸੋਚ ਬਿਲਕੁਲ ਹੀ ਉਲਟ ਹੁੰਦੀ ਹੈ ਪੁਰਾਣੀ ਪੀੜ੍ਹੀ ਦੀ ਸੋਚ ਨੌਜਵਾਨ ਪੀੜ੍ਹੀ ਤੋਂ ਬਿਲਕੁਲ ਅਲੱਗ ਹੈ ਨੌਜਵਾਨ ਪੀੜ੍ਹੀ ਜ਼ਿਆਦਾ ਹੀ ਐਡਵਾਂਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਅਤੇ ਜਿਉਣਾ ਚਾਹੁੰਦੀ ਹੈ ਪਰ ਪੁਰਾਣੀ ਪੀੜ੍ਹੀ ਕਿਰਤ ਕਰਨ ਅਤੇ ਹੱਥੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਨੌਜਵਾਨ ਪੀੜ੍ਹੀ ਇਹ ਚਾਹੁੰਦੀ ਹੈ ਕਿ ਅਸੀਂ ਰਾਤੋ ਰਾਤ ਹੀ ਅਮੀਰ ਹੋ ਜਾਈਏ ਪਰ ਇੱਕ ਪਰਿਵਾਰ ਦੇ ਵਿੱਚ ਇੱਕ ਸੁਖਾਲੀ ਜ਼ਿੰਦਗੀ ਕੱਟਣ ਦੇ ਲਈ ਪੁਰਾਣੀ ਅਤੇ ਨੌਜਵਾਨ ਪੀੜ੍ਹੀ ਦੇ ਵਿਚਕਾਰ ਸੰਤੁਲਨ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਇਹ ਸੰਤੁਲਨ ਮੱਧ ਪੀੜ੍ਹੀ ਜੋ ਕਿ ਬੱਚਿਆਂ ਦੇ ਮਾਤਾ ਪਿਤਾ ਹਨ ਉਹ ਬਣਾ ਸਕਦੇ ਹਨ ਇਹ ਦੋ ਵੱਖ ਵੱਖ ਸੰਸਾਰ ਹਨ ਜਿਸ ਦੀਆਂ ਵੱਖ ਵੱਖ ਕੰਮ ਕਰਨ ਦੀਆਂ ਆਦਤਾਂ ਤਰੀਕੇ ਬਿਲਕੁਲ ਅਲੱਗ ਹਨ ਮੇਰੇ ਹਿਸਾਬ ਦੇ ਨਾਲ ਦੋਨਾਂ ਪੀੜ੍ਹੀਆਂ ਦੇ ਵਿੱਚ ਸਮਾਨਤਾ ਤਾਂ ਮੈਨੂੰ ਕੋਈ ਨਹੀਂ ਲੱਗਦੀ ਪਰ ਇਹਨਾਂ ਦੇ ਵਿੱਚ ਅੰਤਰ ਬਹੁਤ ਹੀ ਜ਼ਿਆਦਾ ਹੈ ਜੋ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ